ਸਤਿ ਸ਼੍ਰੀ ਅਕਾਲ ਜੀ ਪਟਿਆਲਾ ਜਿਲ੍ਹੇ ਵਿੱਚ ਸ਼ਾਕਾਹਾਰੀ ਭੋਜਨ ਵਿੱਚ ਦਾਲ ਮੱਖਣੀ ਸ਼ਾਹੀ ਪਨੀਰ ਕੜਾਹੀ ਪਨੀਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਸਾਨੀ ਨਾਲ ਮਿਲ ਜਾਂਦੇ ਹਨ ਸ਼ਾਹੀ ਪਨੀਰ ਬਣਾਉਣ ਦੇ ਲਈ ਇਸ ਵਿੱਚ ਪਿਆਜ਼ ਲਸਣ ਟਮਾਟਰ ਪਿਓਰੀ ਕਾਲੀ ਮਿਰਚ ਜੀਰਾ ਹੱਥਾਂ ਦੇ ਨਾਲ ਕੁੱਟੇ ਹੋਏ ਮਸਾਲੇ ਜਿਵੇਂ ਕਿ ਧਨੀਆ ਦਾਲ ਚੀਨੀ ਆਦਿ ਪਾਏ ਜਾਂਦੇ ਹਨ ਸ਼ਾਕਾਹਾਰੀ ਭੋਜਨ ਖਾਣ ਦੇ ਲਈ ਜੱਗੀ ਸਵੀਟਸ ਆਗਿਆਪਾਲ ਸਿੰਘ ਦਾ ਢਾਬਾ ਗੋਪਾਲ ਸਵੀਟਸ ਅਨੇਜਾ ਸਵੀਟਸ ਆਦਿ ਮਸ਼ਹੂਰ ਥਾਵਾਂ ਹਨ ਜੇਕਰ ਤੁਸੀਂ ਮਾਸਾਹਾਰੀ ਖਾਣਾ ਖਾਣ ਦੇ ਸ਼ੌਕੀਨ ਹੋ ਤਾਂ ਸੰਨੀ ਦਾ ਢਾਬਾ ਤੋਂ ਬਟਰ ਚਿਕਨ ਰਾੜਾ ਚਿਕਨ ਤੰਦੂਰੀ ਚਿਕਨ ਚਿੱਲੀ ਚਿਕਨ ਦਾ ਆਨੰਦ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਦੇ ਰ ਰਵਾਇਤੀ ਖਾਣਿਆਂ ਦੇ ਵਿੱਚੋਂ ਛੋਲੇ ਭਟੂਰੇ ਬਹੁਤ ਹੀ ਮਸ਼ਹੂਰ ਹਨ ਪਟਿਆਲਾ ਦੇ ਵਿੱਚ ਸਾਧੂ ਰਾਮ ਕਚੋਰੀ ਵਾਲੇ ਦੇ ਪਕੌੜੇ ਸਮੋਸੇ ਕਚੋਰੀਆਂ ਨੂੰ ਲੋਕ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ ਇਸ ਤੋਂ ਇਲਾਵਾ ਫਾਲੂਦਾ ਕੁਲਫੀ ਕੁਲਚੇ ਛੋਲੇ ਆਦਿ ਵੀ ਤੁਸੀਂ ਕਿਲ੍ਹਾ ਚੌਂਕ ਦੇ ਵਿੱਚੋਂ ਆਸਾਨੀ ਨਾਲ ਖਾ ਸਕਦੇ ਹੋ